ਸਾਡੀ ਰਸੋਈ ਵਿੱਚ ਹਰ ਤਰ੍ਹਾਂ ਦੇ ਬਰਤਨ ਮੌਜੂਦ ਆ ਜਿਵੇਂ ਪਰਾਤ ਪਤੀਲਾ ਕੜਾਹੀ ਜਗ ਥਾਲ ਕੌਲੇ ਚਮਚ ਅਤੇ ਹਰੇਕ ਦੀ ਵਰਤੋਂ ਵੱਖਰੀ ਵੱਖਰੀ ਹੈਗੀ ਹੈ ਜਿਵੇਂ ਆਪਾਂ ਪਰਾਤ ਹੈ ਉਹ ਆਟਾ ਗੁੰਨਣ ਵੇ ਵਾਸਤੇ ਵਰਤੋਂ ਵਿੱਚ ਲਿਆਉਂਦੇ ਹਾਂ ਅਤੇ ਪਤੀਲਾ ਆਪਾਂ ਪਾਣੀ ਗਰਮ ਕਰਨ ਵਾਸਤੇ ਚਾਹ ਬਣਾਉਣ ਵਾਸਤੇ ਸਬਜ਼ੀ ਬਣਾਉਣ ਵਾਸਤੇ ਵੀ ਵਰਤ ਲੈ ਵਰਤੋਂ ਵਿੱਚ ਲਿਆਉਂਦੇ ਹਾਂ ਕੜਾਹੀ ਆਪਾਂ ਤੜਕਾ ਲਗਾਉਣ ਵਾਸਤੇ ਵਰਤੋਂ ਵਿੱਚ ਲਿਆਉਦੇ ਹਾਂ ਕੜਛੀ ਲੈ ਕੇ ਆਪਾਂ ਤੜਕੇ ਨੂੰ ਹਿਲਾ ਵੀ ਲੈਂਦੇ ਹਾਂ ਇਸ ਤਰੀਕੇ ਆਪਾਂ ਜਿਹੜੇ ਆ ਬਰਤਨ ਨੇ ਥਾਲ ਹੈ ਚਮਚ ਹੈ ਖਾਣਾ ਖਾਣ ਵਾਸਤੇ ਖਾਣਾ ਫੜਾਉਣ ਵਾਸਤੇ ਆਪਾਂ ਵਰਤੋਂ ਵਿੱਚ ਲਿਆਉਂਦੇ ਹਾਂ ਜੱਗ ਵਿੱਚ ਆਪਾਂ ਪਾਣੀ ਰੱਖ ਲੈਂਦੇ ਹਾਂ ਅਤੇ ਇਸ ਤਰੀਕੇ ਵੱਖ ਵੱਖ ਬਰਤਨ ਜਿਹੜੇ ਆ ਆਪਾਂ ਰਸੋਈ ਦੇ ਜਿਹੜੇ ਹੈ ਨੇ ਵਰਤੋਂ ਵਿੱਚ ਲਿਆਉਂਦੇ ਹਾਂ ਹੋਰ ਵੀ ਬਰਤਨ ਜਿਵੇਂ ਕੜਾਹੀ ਨੂੰ ਕੋਈ ਮਿੱਠਾ ਬਣਾਉਣ ਵਾਸਤੇ ਵੀ ਆਪਾਂ ਵਰਤੋਂ ਵਿੱਚ ਲਿਆ ਸਕਦੇ ਹਾਂ